ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਪੂਜਾ ਸ਼ਰਮਾ ਗੱਲ ਕਰ ਰਹੀ ਹਾਂ ਮੈਂ ਮੀਸ਼ੋ 'ਤੇ ਇੱਕ ਮੀਸ਼ੋ ਕਸਟਮਰ ਕੇਅਰ ਨਾਲ ਗੱਲ ਕਰਨਾ ਚਾਹੁੰਦੀ ਹਾਂ ਸਰ ਮੈਂ ਔਡਰ ਕੀਤਾ ਸੀਗਾ ਇੱਕ ਕੁੜਤੀ ਨਾਇਰਾ ਕੱਟ ਕੁੜਤੀ ਸੀ ਸਰ ਉਹ ਤਾਂ ਉਹ ਸਰ ਹਾਲੇ ਤੱਕ ਮੈਨੂੰ ਡਿਲੀਵਰ ਨਹੀਂ ਹੋਈ ਜਿਹੜੀ ਡੇਟ ਉੱਥੇ ਉਹਨਾਂ ਨੇ ਮੈਨਸ਼ਨ ਕੀਤੀ ਹੋਈ ਸੀ ਵੀ ਤੁਹਾਡਾ ਚੌਦਾਂ ਤਰੀ ਮੈਂ ਵੀਹ ਤਰੀਕ ਨੂੰ ਔਡਰ ਕੀਤਾ ਸੀ ਅਤੇ ਉਹਨਾਂ ਨੇ ਕਿਹਾ ਸੀਗਾ ਵੀ ਤੁਹਾਡਾ ਚੌਦਾਂ ਤਰੀਕ ਨੂੰ ਔਡਰ ਤੁਹਾਡੇ ਕੋਲ ਆ ਜਾਵੇਗਾ ਪਰ ਮੈਨੂੰ ਔਡਰ ਹਾਲੇ ਤੱਕ ਨਹੀਂ ਪਹੁੰਚਿਆ ਅਤੇ ਮੇਰਾ ਔਡਰ ਨੰਬਰ ਹੈਗਾ ਆ ਜੀ ਥਰੀ ਤਿੰਨ ਚਾਰ ਇੱਕ ਤਿੰਨ ਚਾਰ ਤਿੰਨ ਚ ਚਾਰ ਦੋ ਛੇ ਬੀ ਵੰਨ ਸਿਕਸ ਥਰੀ ਏਟ ਈ ਸੈਵਨ ਟੂ ਸਰ ਮੇਰਾ ਇਹ ਔਡਰ ਪਹੁੰਚਿਆ ਨਹੀਂ ਸਰ ਮੈਂ ਅੱਗੇ ਵੀ ਮਤਲਬ ਬਹੁਤ ਔਡਰ ਕੀਤੇ ਆ ਤੁਹਾਡੀ ਐਪ ਤੋਂ ਅਤੇ ਅੱਗੇ ਮੈਨੂੰ ਟਾਈਮ ਨਾਲ ਸਾਰੇ ਔਡਰ ਮਿਲ ਜਾਂਦੇ ਹਨ ਅੱਜ ਮੈਨੂੰ ਔਡਰ ਨਹੀਂ ਮਿਲਿਆ ਸਰ ਪਲੀਜ਼ ਤੁਸੀਂ ਕਨਫਰਮ ਕਰਕੇ ਦੱਸੋ ਕਿ ਔਡਰ ਕਦੋਂ ਤੱਕ ਆਏਗਾ ਇਸ ਲਈ ਮੈਂ ਮੈਰਿਜ 'ਤੇ ਜਾਣਾ ਸੀ ਸਰ ਮੈਨੂੰ ਉਹ ਪ੍ਰੋਡਕਟ ਦੀ ਲੋੜ ਸੀਗੀ ਪਲੀਜ਼ ਤੁਸੀਂ ਮੈਨੂੰ ਹੈਲ ਮੇਰੀ ਹੈਲਪ ਕਰੋ ਅਤੇ ਪਤਾ ਕਰੋ ਕਿ ਮੇਰਾ ਔਡਰ ਕਿਉਂ ਨਹੀਂ ਆਇਆ ਇਸ ਲ ਇਸ ਲਈ ਸਰ ਇਸ ਲਈ ਨ ਮੈਂ ਔਡਰ ਕਰ ਸਕਾਂ ਪਲੀਜ਼ ਮੈਨੂੰ ਰਿਪਲਾਈ ਜਲਦੀ ਤੋਂ ਜਲਦੀ ਦਿਉ ਕਿਉਂਕਿ ਮੈਂ ਸਰ ਮੈਰਿਜ ਅਟੈਂਡ ਕਰਨੀ ਹੈ ਸ ਇਸ ਲਈ ਥੈਂਕ ਯੂ ਸਰ ਹੋਪ ਤੁਸੀਂ ਮੇਰੀ ਹੈਲਪ ਕਰੋਂਗੇ